ਅਸੀਂ ਘਰ ਵਿੱਚ ਇੱਕ ਬਗੀਚਾ ਲਗਾਇਆ ਹੈ ਜਿਸ ਦੇ ਵਿੱਚ ਗੁਲਾਬ ਦੇ ਫੁੱਲ ਲੱਗੇ ਹੋਏ ਹਨ ਗੱਦੀ ਘਾਹ ਲੱਗਿਆ ਹੋਇਆ ਹੈ ਫੁੱਲ ਬੂਟੀ ਲੱਗੀ ਹੋਈ ਹੈ ਮੈਂ ਅਤੇ ਮੇਰੀ ਦਰਾਣੀ ਨੇ ਰਲ ਕੇ ਬਹੁਤ ਸੋਹਣਾ ਬਗੀਚਾ ਲਗਾਇਆ ਹੈ ਸਾਨੂੰ ਇਹਨਾਂ ਚੀਜ਼ਾਂ ਦਾ ਬਹੁਤ ਸ਼ੌਕ ਹੈ ਅਤੇ ਜ ਇਹਨਾਂ ਵਿੱਚੋਂ ਸਾਡੇ ਬਬੀਗ ਬਗੀਚੇ ਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਉੱਗੇ ਹੋਏ ਹਨ ਜਿਸਦੇ ਵਿੱਚ ਇੱਕ ਤੁਲਸੀ ਵੀ ਪੈਦਾ ਕੀਤੀ ਹੋਈ ਹੈ ਅਤੇ ਹੋਰ ਵੀ ਕਈ ਜੀ ਆਈਟਮਾਂ ਲਾਈਆਂ ਹੋਈਆਂ ਹਨ ਅਤੇ ਜਿਸ ਦੇ ਵਿੱਚ ਅਸੀਂ ਹ ਆਪਣਾ ਲੌਂਗਾਂ ਦਾ ਬੂਟਾ ਵੀ ਲਗਾਇਆ ਹੈ ਇਲਾਇਚੀ ਦਾ ਪੌਦਾ ਵੀ ਲਾਇਆ ਸੀ ਸੈਰ ਵੀ ਕਰਦੇ ਹਾਂ ਉਹਦੇ ਵਿੱਚ